ਹਾਂਜੀ ਮੇਰੇ ਕੋਲ ਮੈਂ ਹੁਣੇ ਇੱਕ ਬੁਣਾਈ ਦੀ ਬੁੱਕ ਲਈ ਏ ਜਿਹ 'ਚੋਂ ਮੈਂ ਛੋਟੇ ਬੱਚੇ ਦੀ ਜੁਰਾਬਾਂ ਜਿਵੇਂ ਉਹਨਾਂ ਦੀ ਸਵੈਟਰਸ ਬਣਾਉਣੀ ਜੇ ਹੈ ਸਿੱਖੇ ਨੇ ਅਤੇ ਮੈਂ ਬਣਾਏ ਵੀ ਨੇ ਅਤੇ ਬੜੇ ਸੋਹਣੇ ਬਣੇ ਨੇ ਕਿਉਂਕਿ ਉਸ ਸਿਲਾਈ ਦੇ ਸਿਲਾਈ ਬੁੱਕ ਦੇ ਵਿੱਚ ਬੜੀ ਸੋਹਣੀ ਸੋਹਣੀ ਤਰੀਕੇ ਦੇ ਨਾਲ ਦੱਸਿਆ ਗਿਆ ਹੀ ਬੜੀ ਬਰੀਕੀ ਨਾਲ ਦੱਸਿਆ ਗਿਆ ਹੀ ਜਿਹਨਾਂ ਨੂੰ ਵੇਖ ਵੇਖ ਕੇ ਮੈਂ ਬਣਾ ਲਏ ਨੇ ਇਸ ਤੋਂ ਇਲਾਵਾ ਮੇਰਾ ਮੇਰਾ ਮੈਂ ਸਿਲਾਈ ਦਾ ਕੰਮ ਵੀ ਕਰਦੀ ਹਾਂ ਅਤੇ ਮੈਂ ਸੋਸ਼ਲ ਮੀਡੀਆ 'ਚ ਬੜੇ ਚੈਨਲ ਨੇ ਜੋ ਸਿਲਾਈ ਸਿਖਾ ਦੇ ਸਿਖਾਉਂਦੇ ਨੇ ਉਹਨਾਂ ਤੋਂ ਮੈਂ ਸਿੱਖ ਕੇ ਅਤੇ ਮੈਂ ਅੱਗੇ ਲੋਕ ਬਹੁਤ ਸਾਰੇ ਲੋਕਾਂ ਨੂੰ ਸਿਖਾ ਰਹੀ ਹਾਂ ਅਤੇ ਪ੍ਰੇਰਿਤ ਹੋ ਕੇ ਹੀ ਮੈਂ ਆਪਣੀ ਬੁਟੀਕ ਖੋਲ੍ਹੀ ਏ ਅਤੇ ਬੁਟੀਕ ਦੇ ਵਿੱਚ ਮੈਂ ਜੈਨੁਅਨ ਜਿਵੇਂ ਪ੍ਰਾਈਜ ਰੱਖੇ ਹੋਏ ਨੇ ਅਤੇ ਜਿਹ ਤੋਂ ਜ ਹਰ ਕੋਈ ਬੰਦਾ ਜੋ ਹੈ ਉਹ ਸਿਲਾਈ ਜਿਹੜਾ ਏ ਉਹ ਆਪਣੀ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਜੋ ਹੈ ਮੈਂ ਇਸ ਤੋਂ ਇਲਾਵਾ ਮੈਂ ਨਾ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਕੈਂਪ ਲਗਾ ਰਹੀ ਹਾਂ ਉਹਨਾਂ ਕੈਂਪਾਂ ਦੇ ਵਿੱਚ ਜਿਵੇਂ ਲੋਕਾਂ ਨੂੰ ਸਿਲਾਈ ਵਗੈਰਾ ਸਿਖਾ ਰਹੀ ਹਾਂ ਤਾਂ ਜੋ ਹਰ ਕੋਈ ਬੰਦਾ ਜੋ ਹੈ ਮਤਲਬ ਹਰ ਲੇਡੀ ਜੋ ਹੈ ਉਹ ਇੱਕ ਤਾਂ ਸੈਲਫ ਡਿਪੈਂਡ ਹੋ ਸਕੇ ਦੂਸਰਾ ਜੋ ਹੈ ਆਪਣਾ ਸੂਟ ਐਟਲੀਸਟ ਉਹ ਆਪਣਾ ਸੂਟ ਤਾਂ ਖੁਦ ਹੀ ਸਿਲ ਸਕੇ ਨ ਕਿਉਂਕਿ ਇਸ ਟਾਈਮ ਸਟਿਚਿੰਗ ਬਹੁਤ ਜ਼ਿਆਦਾ ਮਹਿੰਗੀ ਹੈਗੀ ਆ ਅਤੇ ਹਰ ਕੋਈ ਬੰਦਾ ਜਿਹੜਾ ਏ ਉਹ ਸੋਚਦਾ ਏ ਕਿ ਮੈਂ ਘਰ ਵਾਲ ਘਰ ਪਾਉਣ ਵਾਲਾ ਸੂਟ ਦੀ ਵੀ ਇੰਨੀ ਸਟਿਚਿੰਗ ਜੋ ਹੈ ਭਰਨੀ ਜਿਹੜੀ ਏ ਉਹਦੇ ਲਈ ਬੜੀ ਮੁਸ਼ਕਿਲ ਏ ਇਸ ਲਈ ਉਹ ਕੀ ਮੈਂ ਇਸ ਛੋਟੀ ਛੋਟੇ ਕੈਂਪ ਲਗਾ ਕੇ ਜਿਵੇਂ ਦਸ ਦਿਨ ਦੇ ਪੰਦਰਾਂ ਦਿਨ ਦੇ ਉਹਨਾਂ ਨੂੰ ਜੋ ਹੈ ਮਤਲਬ ਉਹ ਬੰਦਾ ਸਿੰਪਲ ਸੂਟ ਤਾਂ ਆਪਣੀ ਸਟਿਚਿੰਗ ਸਟਿਚ ਐਟਲੀਸਟ ਕਰ ਸਕਦਾ ਹੈ ਅਤੇ ਬੜੇ ਲੋਕਾਂ ਨੇ ਜੋ ਹੈ ਉਹ ਸਿੱਖਿਆ ਵੀ ਹੈ ਅਤੇ ਬੜੇ ਲੋਕ ਜੋ ਹੈ ਖੁਸ਼ ਵੀ ਨੇ ਮੇਰੇ ਤੋਂ ਕਿਉਂਕਿ ਮੈਂ ਉਹਨਾਂ ਦੀ ਜੈ ਉਹਨਾਂ ਨੂੰ ਸਿਖਾਇਆ ਹੈ